ਸਾਡੇ ਖੇਤਰ ਵਿੱਚ ਮੁੱਖ ਕਿੱਤਾ ਵਾ ਜਿਸ ਨਾਲ ਹੁਣ ਸਾਡੇ ਫਸਲਾਂ ਖੇਤੀ ਕੀਤੀ ਜਾਂਦੀ ਹੈ ਸਰ੍ਹੋਂ ਦੇ ਫੁੱਲਾਂ ਨਾਲ ਲੋਕ ਸ਼ਹਿਰਾਂ ਤੋਂ ਆਉਂਦੇ ਨੇ ਇਹ ਆਉਣ ਕੇ ਸੈਲਾਨੀ ਆਉਣ ਕੇ ਇੱਥੇ ਸ਼ੁੱਧ ਹਵਾ ਲੈਂਦੇ ਨੇ ਸਾਡੇ ਖੇਤਾਂ ਵਿੱਚ ਆਉਣ ਕੇ ਸਾਡੇ ਫੁੱਲਾਂ ਦੀ ਸਰ੍ਹੋਂ ਦੇ ਫੁੱਲ ਖਿੜ੍ਹੇ ਹੁੰਦੇ ਨੇ ਉਹਨਾਂ ਨਾਲ ਫੋਟੋਆਂ ਖਿਚਾਉਂਦੇ ਹਨ ਇੰਨਜੋਏ ਕਰਦੇ ਆ ਇਹ ਜੀ ਮਿੱਟੀ ਦੇ ਬਰਤਨ ਵੀ ਬਣਾਏ ਜਾਂਦੇ ਆ ਇੱਥੇ ਸਾਡੇ ਸਾਨੂੰ ਇਹਦੇ ਵਿੱਚ ਮੁਸ਼ਕਿਲ ਇਹ ਆਉਂਦੀ ਹੈ ਕਿ ਜਦੋਂ ਇੰਨੀ ਦੂਰੋਂ ਮਿੱਟੀ ਲਿਆ ਕੇ ਉਹ ਮਟਕੇ ਬਣਾਉਂਦੇ ਉਹਨਾਂ ਦੇ ਫਾਇਦੇ ਵੀ ਹੁੰਦੇ ਆ ਕਿ ਉਹਨਾਂ ਵਿੱਚ ਸ਼ੁੱਧ ਪਾਣੀ ਪੀਤਾ ਜਾਂਦਾ ਰੱਖਿਆ ਜਾਂਦਾ ਹੈ ਅਤੇ ਜਦੋਂ ਇਹ ਟੁੱਟ ਜਾਂਦੇ ਤਾਂ ਸਾਡਾ ਨੁਕਸਾਨ ਵੀ ਹੁੰਦਾ ਹੈ ਫਿਰ ਕੋਟੀਆਂ ਬਣਾਈਆਂ ਜਾਂਦੀਆਂ ਨੇ ਬੱਚਿਆਂ ਨੂੰ ਨਿੱਘ ਵੀ ਮਿਲਦਾ ਹੈ ਸ਼ਹਿਰੀ ਜਿਹੜੀਆਂ ਬੁਣਤੀਆਂ ਹੁੰਦੀਆਂ ਨੇ ਉਹਨਾਂ ਵਿੱਚ ਨਿੱਘ ਨਹੀਂ ਹੁੰਦਾ ਫਿਰ ਅਸੀਂ ਮਿੱਟੀ ਦੀਆਂ ਮੂਰਤੀਆਂ ਵੀ ਬਣਾਉਂਦੇ ਹਾਂ ਉਹਨਾਂ ਨੂੰ ਵੇਚੀਆਂ ਜਾਂਦੀਆਂ ਅਤੇ ਫਾਇਦਾ ਲਿਆ ਜਾਂਦਾ ਪੈਸੇ ਵੱਟੇ ਜਾਂਦੇ ਨੇ ਅਤੇ ਉਹਨਾਂ ਦਾ ਨੁਕਸਾਨ ਇਹ ਹੁੰਦਾ ਕਿ ਉਹ ਜਿੱਦਾਂ ਉਹਨੂੰ ਮਿੱਟੀ ਦੀ ਮੂਰਤੀ ਬਣਾਈ ਉਹ ਵੀ ਟੁੱਟ ਵੀ ਜਾਂਦੀ ਫਿਰ ਸਾਡਾ ਉਹਦੇ ਵਿੱਚ ਨੁਕਸਾਨ ਵੀ ਹੋ ਜਾਂਦਾ ਸਾਨੂੰ ਫਾਇਦੇ ਵੀ ਬਹੁਤ ਇਹਨਾਂ ਦੇ ਅਤੇ ਨੁਕਸਾਨ ਵੀ ਹੁੰਦੇ ਆ ਖੇਤੀ ਵਿੱਚ ਬਹੁਤ ਜਿੱਦਾਂ ਆਹ ਹੁਣ ਸਾਨੂੰ ਖੇਤੀ ਵਿੱਚ ਵੀ ਬਹੁਤ ਸਾਰੇ ਫਾਇਦੇ ਹੁੰਦੇ ਆ ਅਤੇ ਮਿੱਟੀ ਦੇ ਬਰਤਨ ਮੂਰਤੀਆਂ ਹਰ ਇੱਕ ਚੀਜ਼ ਵਿੱਚ ਫਾਇਦਾ ਵੀ ਹੈ ਅਤੇ ਨੁਕਸਾਨ ਵੀ ਫਾਇਦਾ ਇਹ ਆ ਕਿ ਸਾਨੂੰ ਵਧੀਆ ਤਰੀਕੇ ਨਾਲ ਪਾਣੀ ਮਿਲਦਾ ਹੈ ਪੈਸੇ ਵੀ ਮਿਲਦੇ ਨੇ ਜਦੋਂ ਅਸੀਂ ਇਹਨਾਂ ਨੂੰ ਮੂਰਤੀਆਂ ਬਣਾਉਂਦੇ ਹਾਂ ਵੇਚਦੇ ਹਾਂ ਮਿੱਟੀ ਦੇ ਬਰਤਨ ਬਣਾਉਂਦੇ ਵੇਚਦੇ ਹਾਂ